ਨਮਸਤੇ ਦੋਸਤੋ ਮੈਂ ਆਪਣੇ ਨਵੇਂ ਜੀਵਨ ਦੇ ਸ਼ੁਰੂਆਤ ਹੋਣ ਤੋਂ ਬਾਅਦ ਤੁਹਾਨੂੰ ਆਪਣਾ ਪਹਿਲਾ ਵਲੋਗ ਲੈ ਕੇ ਆਇਆ ਹਾਂ ਮੇਰਾ ਵਿਆਹ ਹੋਇਆ ਹੈ ਅਤੇ ਮੈਂ ਬਹੁਤ ਖੁਸ਼ ਹਾਂ ਹੁਣ ਮੈਨੂੰ ਆਪਣੇ ਆਧਾਰ ਨੂੰ ਨਵੇਂ ਉਪਨਾਮ ਨਾਲ ਅਪਡੇਟ ਕਰਨ ਦੀ ਜ਼ਰੂਰਤ ਹੈ ਇਹ ਮੇਰੇ ਲਈ ਇੱਕ ਨਵਾਂ ਅਨੁਭਵ ਹੈ ਇਸ ਲਈ ਮੈਂ ਤੁਹਾਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਸਦਾ ਦੇ ਰਿਹਾ ਹਾਂ ਤੁਸੀਂ ਕਿਵੇਂ ਸੋਚਦੇ ਹੋ ਕਿ ਮੈਂ ਆਪਣੇ ਆਧਾਰ ਨੂੰ ਅਪਡੇਟ ਕਰਨ ਲਈ ਕਿਹੜਾ ਸਭ ਤੋਂ ਵਧੀਆ ਤਰੀਕਾ ਵਰਤਣਾ ਚਾਹੀਦਾ ਹੈ ਕੀ ਮੈਂ ਆਨਲਾਈਨ ਪ੍ਰਕਿਰਿਆ ਨੂੰ ਅਪਣਾਉਣਾ ਚਾਹੀਦਾ ਹੈ ਜਾਂ ਸਰਕਾਰੀ ਦਫਤਰ ਜਾਣਾ ਚਾਹੀਦਾ ਹੈ ਮੈਨੂੰ ਤੁਹਾਡੇ ਸੁਝਾਅ ਦੀ ਉਡੀਕ ਹੈ ਕਿਰਪਾ ਕਰਕੇ ਆਪਣੇ ਵਿਚਾਰ ਸਾਂਝੇ ਕਰੋ